ਸਿੱਖਿਆ ਨੇ ਸੱਭਿਆਚਾਰਿਕ ਅਭਿਆਸਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਦੋਂ ਪੁਰਾਣੇ ਸਮੇਂ ਵਿੱਚ ਕਿਸੇ ਥਾਂ 'ਤੇ ਮੇਲੇ ਲੱਗਦੇ ਸੀ ਤਾਂ ਲੋਕ ਉੱਚੀ ਉੱਚੀ ਆਵਾਜ਼ ਗਾਉਂਦੇ ਸੀ ਪਰ ਅੱਜ ਦੇ ਜ਼ਮਾਨੇ ਵਿੱਚ ਲੋਕ ਮੈਕ ਅਤੇ ਡੀਜਿਆਂ ਦਾ ਪ੍ਰਯੋਗ ਕਰਨ ਲੱਗ ਪਏ ਹਨ ਸਵੀਕਰਾਂ ਦਾ ਪ੍ਰਯੋਗ ਕਰਨ ਲੱਗ ਪਏ ਹਨ ਇਸ ਕਰਕੇ ਇਸ ਜ਼ਮਾਨੇ ਵਿੱਚ ਬਹੁਤ ਹੀ ਨਵੀਆਂ ਨਵੀਆਂ ਤਕਨੀਕਾਂ ਆ ਗਈਆਂ ਹਨ ਜਿਨ੍ਹਾਂ ਦਾ ਸਾਨੂੰ ਬਹੁਤ ਹੀ ਜ਼ਿਆਦਾ ਲਾਭ ਹੋਇਆ ਹੈ ਸੱਭਿਆਚਾਰਕ ਵਿੱਚ ਹਮੇਸ਼ਾ ਹੀ ਅਭਿਆਸ ਉੱਚੇ ਰਹੇ ਹਨ ਸਾਦੇ ਸਾਡੇ ਅਹੁਦੇ ਉੱਚੇ ਰਹੇ ਹਨ ਕਦੇ ਵੀ ਸਾਨੂੰ ਇੰਝ ਨੀ ਜਾਪਿਆ ਕਿ ਸਾਨੂੰ ਸੱਭਿਆਚਾਰਿਕ ਬਾਰੇ ਪਤਾ ਨਹੀਂ ਹੈ ਪਰ ਸੱਭਿਆਚਾਰਕ ਅਭਿਆਸਾਂ ਵਿੱਚ ਸਭ ਤੋਂ ਉੱਚੇ ਪੱਧਰ ਵਿੱਚ ਲੋਕਾਂ ਨੇ ਕਈ ਤਰ੍ਹਾਂ ਦੇ ਨਾਮ ਕਮਾਏ ਹਨ ਸੱਭਿਆਚਾਰਕ ਇੱਕ ਸ਼੍ਰੇਣੀ ਵਿੱਚ ਮੁੱਖ ਮੰਨਿਆ ਗਿਆ ਹੈ ਇਸ ਕਰਕੇ ਇਸ ਸਿੱਖਿਆ ਨੇ ਪੰਜਾਬ ਨੂੰ ਬਹੁਤ ਹੀ ਜਿਆਦਾ ਅੱਗੇ ਲਿਆਂਦਾ ਹੈ ਤੇ ਸੱਭਿਆਚਾਰਕ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਇਸ ਕਰਕੇ ਸੱਭਿਆਚਾਰ ਨੂੰ ਬੜੇ ਹੀ ਤਿਉਹਾਰਾਂ ਵਿੱਚ ਪਰਿਵਰਤਨ ਕੀਤਾ ਗਿਆ ਹੈ ਜਿਵੇਂ ਕਿ ਸੱਭਿਆਚਾਰਕ ਤਿਉਹਾਰ ਜਦੋਂ ਵੀ ਲੱਗਦੇ ਹਨ ਤਾਂ ਮੇਲੇ ਅਤੇ ਗਲੀਆਂ ਹਰ ਇੱਕ ਥਾਂ 'ਤੇ ਦੁਕਾਨਾਂ ਲੱਗੀਆਂ ਹੁੰਦੀਆਂ ਹਨ ਸੱਭਿਆਚਾਰਕ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੱਭਿਆਚਾਰਕ ਦੇ ਬਹੁਤ ਹੀ ਜ਼ਿਆਦਾ ਅਭਿਆਸ ਹਨ